ਮੈਂ ਨੇੜਲੇ ਪਿੰਡਾਂ ਵਿੱਚ ਡੇਲੀ ਕਈ ਵਾਰ ਦੋ ਤੋਂ ਤਿੰਨ ਵਾਰ ਦੌਰਾ ਕਰਦਾ ਜੀ ਪਹਿਲਾਂ ਤਾਂ ਮੈਂ ਸਵੇਰੇ ਜਾਂਦਾ ਜੀ ਆਪਣੀ ਡਿਊਟੀ ਵਾਸਤੇ ਮੇਰਾ ਕਲੈਕਸ਼ਨ ਦਾ ਕੰਮ ਹੈ ਜੀ ਕਦੇ ਕਿਸੇ ਬੰਦੇ ਨੂੰ ਮਿਲਣਾ ਕਦੇ ਕਿਸੇ ਨੂੰ ਪੇਮੈਂਟ ਕਲੈਕਟ ਕਰਨੀ ਜੀ ਅਤੇ ਉਸ ਤੋਂ ਬਾਅਦ ਕਿਤੇ ਕੋਈ ਰਿਸ਼ਤੇਦਾਰੀ ਆ ਗਈ ਉੱਥੇ ਚਲੇ ਜਾਣਾ ਕੋਈ ਯਾਰ ਦੋਸਤ ਆ ਗਿਆ ਉਹਨਾਂ ਨੂੰ ਮਿਲ ਲੈਣਾ ਕਿਤੇ ਕੋਈ ਮੈਸੇਜ ਦੇਣਾ ਕਿਸੇ ਨੂੰ ਉਹ ਦੇ ਆਉਣਾ ਕਦੇ ਕੋਈ ਹੁੰਦਾ ਸਮਾਨ ਵਗੈਰਾ ਲੈ ਕੇ ਆਉਣਾ ਉਹ ਲੈ ਕੇ ਆਉਣਾ ਜੀ ਸ਼ਾਮ ਟਾਈਮ ਸੈਰ ਕਰਨ ਜਾਣਾ ਤਾਂ ਘੱਟੋ ਘੱਟ ਦੋ ਜਾਂ ਤਿੰਨ ਪਿੰਡਾਂ ਦਾ ਦੌਰਾ ਉਸ ਸਮੇਂ ਵੀ ਕਰ ਲੈਂਦਾ ਜੀ ਉਸ ਤੋਂ ਬਾਅਦ ਫਰੀ ਹੁੰਦੇ ਹਾਂ ਘੁੰਮਣ ਫਿਰਨ ਜਾ ਚਲੇ ਜਾਈਦਾ ਯਾਰਾਂ ਦੋਸਤਾਂ ਨੂੰ ਮਿਲਣ ਜਾਈਦਾ ਸਾਰਿਆਂ ਨੂੰ ਮਿਲਣ ਰਿਸ਼ਤੇਦਾਰੀਆਂ ਹੋ ਗਈਆਂ ਅਤੇ ਉੱਦਾਂ ਕੋਈ ਫੰਕਸ਼ਨ ਹੋ ਗਿਆ ਉਹ ਅਟੈਂਡ ਕਰਨਾ ਇੱਕ ਦਿਨ ਮਹੀਨੇ ਦਾ ਕਹੂੰਗਾ ਮਹੀਨੇ 'ਚ ਤਾਂ ਕਈ ਵਾਰ ਦੌਰਾ ਕਰ ਦਿੰਦੇ ਕਈ ਪਿੰਡਾਂ ਦਾ ਅਤੇ ਜ਼ਿਆਦਾਤਰ ਦੌਰਾ ਤਾਂ ਜਿਸ ਜਿਸ ਟਾਈਮ ਕੰਮ 'ਤੇ ਹੁੰਦੇ ਉਸ ਸਮੇਂ ਹੁੰਦਾ ਜੀ